ਹੈਲੋ ਮੈਂ ਜਿਹੜੇ ਔਨਲਾਈਨ ਸ਼ੋਪਿੰਗ ਐਪ ਹੈਗੀ ਆ ਫਲਿੱਪਕਾਰਟ ਮੈਂ ਉਹਦੇ ਤੋਂ ਇੱਕ ਪ੍ਰੋਡਕਟ ਮੰਗਵਾਇਆ ਸੀ ਕੁਝ ਦਿਨ ਪਹਿਲਾਂ ਅਤੇ ਜਿਹੜਾ ਪ੍ਰੋਡਕਟ ਸੀ ਉਹ ਮੈਂ ਮੰਗਵਾਇਆ ਸੀ ਡੈੱਲ ਕੰਪਨੀ ਦਾ ਲੈਪਟੋਪ ਜਿਹੜਾ ਕਿ ਮੈਨੂੰ ਡਿਲੀਵਰੀ ਡੇਟ ਦੱਸਣ ਦੇ ਬਾਵਜੂਦ ਵੀ ਦੋ ਤਿੰਨ ਦਿਨ ਜਿਹੜਾ ਸੀ ਉਹ ਲੇਟ ਪਹੁੰਚਿਆ ਅਤੇ ਜਿਹੜਾ ਲੈਪਟੋਪ ਸੀ ਉਹ ਕਾਫ਼ੀ ਕੋਸਟਲੀ ਵੀ ਹੈਗਾ ਸੀ ਕਿਉਂਕਿ ਸੇਮ ਵਰਜ਼ਨ ਦਾ ਲੈਪਟੋਪ ਜਿਹੜਾ ਹੈਗਾ ਵਾ ਉਹ ਸਾਡੇ ਜਿਹੜੇ ਰਿਸ਼ਤੇਦਾਰਾਂ ਕੋਲ ਜਾਂ ਜਿਹੜੇ ਮੇਰੇ ਦੋਸਤ ਹੈਗੇ ਆ ਉਹਨਾਂ ਕੋਲ ਵੀ ਹੈਗਾ ਹੈ ਅਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਜਿਹੜਾ ਲੈਪਟੋਪ ਤੂੰ ਖਰੀਦਿਆ ਹੈਗਾ ਔਨਲਾਈਨ ਉਹ ਤੈਨੂੰ ਕਾਫ਼ੀ ਮਹਿੰਗਾ ਪਿਆ ਹੈਗਾ ਅਤੇ ਉਹਦੇ ਨਾਲ ਮੈਨੂੰ ਅਸੈਸਰੀ ਜਿਹੜੀ ਸੀ ਉਹ ਕਾਫ਼ੀ ਘੱਟ ਮਿਲੀ ਅਸੈਸਰੀ ਮੈਨੂੰ ਸਾਰੀ ਬਜ਼ਾਰੋ ਖਰੀਦਣੀ ਪਈ ਅਤੇ ਉਹਦਾ ਜਿਹੜਾ ਹੈਗਾ ਵਾ ਵਿੰਡੋ ਸਟੋਰੇਜ ਜਿਹੜੀ ਉਹਦੀ ਹੈਗੀ ਆ ਉਹ ਵੀ ਕਾਫ਼ੀ ਘੱਟ ਆ ਕਿਉਂਕਿ ਉਹ ਪਹਿਲਾ ਤਾਂ ਇੱਕ ਅੱਧਾ ਦਿਨ ਉਹਨੇ ਸਹੀ ਕੰਮ ਕੀਤਾ ਅਤੇ ਫਿਰ ਮੈਂ ਜਦੋਂ ਉਹਦੇ 'ਤੇ ਰੈਗੂਲਰ ਵਰਕ ਸ਼ੁਰੂ ਕੀਤਾ ਲੈਪਟੋਪ 'ਤੇ ਕੰਮ ਕਰਨਾ ਅਤੇ ਉਹਦੇ ਜਿਹੜੀ ਸਟੋਰੇਜ ਪਾਵਰ ਸੀ ਤਾਂ ਉਹ ਵੀ ਇੰਨੀ ਜਿਹੜੀ ਨਹੀਂ ਸੀ ਹੈਗੀ ਅਤੇ ਉਹ ਜਿਹੜਾ ਡਾਟਾ ਹੈਗਾ ਸੀ ਅਤੇ ਉਹ ਵੀ ਜ਼ਿਆਦਾ ਕੰਮ ਨਹੀਂ ਸੀ ਸਟੋਰ ਕਰ ਉਹ ਵੀ ਲੈਪਟਾਪ ਜਿਹੜਾ ਡਾਟਾ ਵੀ ਜ਼ਿਆਦਾ ਸਟੋਰ ਨਹੀਂ ਸੀ ਕੰਮ ਕਰ ਰਿਹਾ ਅਤੇ ਜਿਸ ਤਰ੍ਹਾਂ ਕਿ ਮੈਂ ਉਹਨੂੰ ਵਰਤੋਂ 'ਚ ਲਿਆਉਂਦੀ ਸੀ ਜ਼ਿਆਦਾ ਸਮੇਂ ਜਦੋਂ ਮੈਂ ਵਰਤਦੀ ਸੀ ਤਾਂ ਉਹ ਜਿਹੜੀ ਸੀ ਬੈਟਰੀ ਵੀ ਛੇਤੀ ਲੋਅ ਹੋ ਜਾਂਦੀ ਸੀ ਅਤੇ ਉਹ ਹੀਟ ਵੀ ਪ੍ਰੋਡਿਊਸ ਕਰਨ ਲੱਗ ਜਾਂਦਾ ਹੈਗਾ ਸੀ ਅਤੇ ਮੈਂ ਤੁਹਾਡੇ ਪ੍ਰੋਡਕਟ ਤੋਂ ਬਿਲਕੁਲ ਸੈਟਿਸਫਾਈ ਨਹੀਂ ਹੈਗੀ